ਪੁਰਾਣੇ ਸਮੇਂ ਵਿੱਚ ਕੱਪੜੇ ਧੋਣ ਦਾ ਤਰੀਕਾ ਬਹੁਤ ਵਧੀਆ ਸੀ ਬਾਹਰ ਤਲਾਬਾਂ 'ਤੇ ਜਾ ਜਾ ਕੇ ਧੋਂਦੇ ਸੀ ਅਤੇ ਹੁਣ ਦੇ ਸਮੇਂ ਵਿੱਚ ਤਾਂ ਬਹੁਤ ਗ਼ਲਤ ਹੋ ਗਿਆ ਹੈ ਘਰਾਂ ਦੇ ਵਿੱਚ ਹੀ ਧੋਣਾ ਜਦੋਂ ਅਸੀਂ ਕੱਪੜੇ ਧੋਆਂਦੇ ਸੀਗੇ ਅਤੇ ਘਰਾਂ ਦੇ ਵਿੱਚ ਸਰਫ਼ ਦੇ ਵਿੱਚ ਪਾਣੀ ਦੇ ਵਿੱਚ ਡੋਬ ਦੇਣੇ ਉਸ ਤੋਂ ਬਾਅਦ ਫਿਰ ਬਾਲਟੀ ਚੱਕ ਕੇ ਲੈ ਕੇ ਜਾਣੀ ਤਲਾਬ ਦੇ ਉੱਪਰ ਤਲਾਬ ਦੇ ਉੱਪਰ ਪੱਥਰ ਦੇ ਉੱਪਰ ਰੱਖ ਕੇ ਕੱਪੜੇ ਮਲਣੇ ਧੋਣੇ ਸਾਬਣ ਲਗਾਉਣਾ ਫਿਰ ਬਾਲਟੀ ਵਿੱਚ ਤਲਾਬ ਵਿੱਚੋਂ ਪਾਣੀ ਲੈ ਕੇ ਫਿਰ ਉਹ ਸਾਫ਼ ਕਰਨੇ ਧੋਣੇ ਫਿਰ ਉੱਥੇ ਹੀ ਤਾਰਾਂ ਗੱਡੀਆਂ ਹੋਣੀਆਂ ਉਹਨਾਂ ਤਾਰਾਂ ਪਰ ਖੁੱਲ੍ਹੇ ਖੇਤ ਵਿੱਚ ਸੁਕਣੇ ਪਾ ਦੇਣੇ ਅਤੇ ਅੱਜ ਕੱਲ੍ਹ ਮ ਵਾਸ਼ਿੰਗ ਮਸ਼ੀਨਾਂ ਦਾ ਜਮਾਨਾ ਆ ਗਿਆ ਹੈ ਲੋਕ ਵਾਸ਼ਿੰਗ ਮਸ਼ੀਨਾਂ ਵਿੱਚ ਕੱਪੜੇ ਧੋਂਦੇ ਹਨ ਅਤੇ ਬਾਹਰ ਕੋਠੇ ਉੱਪਰ ਜਾ ਕੇ ਸੁੱਕਣੇ ਪਾਉਂਦੇ ਹਨ ਫਿਰ ਅੱਜ ਕੱਲ੍ਹ ਹੋਰ ਨਵੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੋ ਕਿ ਵਿੱਚ ਹੀ ਕੱਪੜੇ ਸੁੱਕਾ ਦਿੰਦੀਆਂ ਹਨ ਧੋਣ ਤੋਂ ਬਾਅਦ ਅਤੇ ਉਸ ਦੇ ਨਾਲ਼ ਤਾਂ ਜ਼ਿਆਦਾ ਬੰਦੇ ਦੀ ਸਿਹਤ ਪਰ ਨੁਕਸਾਨ ਜ਼ਿਆਦਾ ਪੈ ਰਿਹਾ ਹੈ ਪਹਿਲਾਂ ਚੱਲ ਕੇ ਖੇਤ ਵਿੱਚ ਜਾਣਾ ਉੱਥੇ ਜਾ ਕੇ ਕੱਪੜੇ ਧੋਂਦੇ ਸੀਗੇ ਅਤੇ ਜਿਸ ਦੇ ਨਾਲ਼ ਸਿਹਤ ਵੀ ਠੀਕ ਰਹਿੰਦੀ ਸੀ ਤੁਰਦਾ ਫਿਰਦਾ ਵੀ ਸੀ ਬੰਦਾ ਹੁਣ ਘਰ ਦੇ ਵਿੱਚ ਹੀ ਇਹ ਚੀਜ਼ਾਂ ਆ ਗਈਆ ਹਨ ਜਿਹਦੇ ਕਰਕੇ ਬੰਦਾ ਬਿਮਾਰ ਰਹਿੰਦਾ ਹੈ ਕੰਮ ਕਰਦਾ ਨਹੀਂ ਹੈ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਸਿੱਟ ਦਿੰਦੇ ਹਨ ਉਹ ਧੋ ਦਿੰਦੀ ਹੈ ਵਿੱਚੇ ਸੁੱਕਾ ਦਿੰਦੀ ਹੈ ਅਤੇ ਬੰਦਾ ਉਸ ਤਰ੍ਹਾਂ ਹੀ ਕੱਪੜੇ ਪਾ ਕੇ ਤੁਰ ਪੈਂਦਾ ਹੈ ਜਿਹਨਾਂ ਚੀਜ਼ਾਂ ਨਾਲ਼ ਨੁਕਸਾਨ ਵੀ ਹੈ ਅਤੇ ਫਾਇਦਾ ਵੀ ਹੈ ਪਰ ਪੁਰਾਣਾ ਸਮਾਂ ਵਧੀਆ ਸੀਗਾ ਪੁਰਾਣੇ ਸਮੇਂ ਨਾਲ਼ ਹੀ ਸਾਨੂੰ ਚੱਲਣਾ ਚਾਹੀਦਾ ਹੈ